ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਭਰ ਵਿੱਚ ਅੱਜ ਕੱਲ੍ਹ ਮੂਵੀ ਸਿਨੇਮੇ ਖੁੱਲ੍ਹੇ ਹੋਏ ਹਨ ਮੈਂ ਜ਼ਿਆਦਾਤਰ ਤਾਂ ਸਿਨੇਮੇ ਵਿੱਚ ਨਹੀਂ ਗਈ ਪਰ ਮੈਂ ਦੋ ਜਾਂ ਤਿੰਨ ਵਾਰ ਜ਼ਰੂਰ ਗਈ ਹਾਂ ਹਰੇਕ ਹਫ਼ਤੇ ਦੇ ਸ਼ੁੱਕਰਵਾਰ ਨੂੰ ਜੋ ਵੀ ਮੂਵੀ ਰਿਲੀਜ਼ ਹੁੰਦੀ ਹੈ ਉਹ ਸਿਨੇਮੇ ਵਿੱਚ ਸ਼ੁੱਕਰਵਾਰ ਨੂੰ ਲੱਗ ਜਾਂਦੀ ਹੈ ਹਰ ਇੱਕ ਸਿਨੇਮੇ ਦਾ ਆਪਣਾ ਆਪਣਾ ਟਿਕਟ ਰੇਟ ਹੈ ਅਤੇ ਅਸੀਂ ਜ਼ਿਆਦਾਤਰ ਟਿਕਟ ਔਨਲਾਈਨ ਹੀ ਬੁੱਕ ਕੀਤੀ ਸੀ ਅਸੀਂ ਖੰਨੇ ਦੇ ਸ ਸੈਲੀਰੇਸ਼ਨ ਸਿਨਮੇ ਵਿੱਚ ਇੱਕੋ ਮੇ ਇੱਕ ਮਿਲ ਕੇ ਫਿਲਮ ਦੇਖਣ ਗਏ ਅਤੇ ਟਿਕਟ ਦਾ ਰੇਟ ਵੀ ਤਕਰੀਬਨ ਨੱਬੇ ਰੁਪਏ ਸੀ ਉੱਥੇ ਖਾਣ ਨੂੰ ਅੱਸੀ ਰੁਪਏ ਦੇ ਪੋਪਕਨ ਦੋ ਵਾਰ ਮਿਲਦੇ ਸਨ